ਪਕਾਉਣ ਲਈ ਮੇਰੀ ਪਸੰਦੀਦਾ ਕਿਸਮ ਦਾ ਪਕਵਾਨ ਖੀਰ ਹੈ ਕਿਉਂਕਿ ਸਭ ਤੋਂ ਵੱਧ ਵਧੀਆ ਮੈਨੂੰ ਪਕਵਾਨ ਵਿੱਚ ਖੀਰ ਹੀ ਲੱਗਦੀ ਹੈ ਇਹ ਮੇਰੇ ਬਚਪਨ ਦਾ ਪਸੰਦੀਦਾ ਪਕਵਾਨ ਵਿੱਚੋਂ ਇੱਕ ਹੈ ਕਿਉਂਕਿ ਇਹ ਬਹੁਤ ਹੀ ਮਿੱਠਾ ਪਕਵਾਨ ਹੈ ਅਤੇ ਮੈਂ ਇਸਨੂੰ ਬਹੁਤ ਹੀ ਖੁਸ਼ੀ ਨਾਲ ਅਤੇ ਐਕਸਾਈਟ ਹੋ ਕੇ ਖਾਂਦਾ ਹਾਂ ਅਤੇ ਮੈਂ ਇਸਨੂੰ ਬੜੇ ਹੀ ਵਧੀਆ ਅਤੇ ਮਜੇ ਹੋਏ ਤਰੀਕੇ ਨਾਲ ਬਣਾਉਣਾ ਪਸੰਦ ਕਰਦਾ ਹਾਂ ਮੈਨੂੰ ਖੀਰ ਬਣਾਉਣਾ ਅਤੇ ਖਾਣਾ ਦੋਨੋਂ ਹੀ ਬਹੁਤ ਪਸੰਦ ਹਨ ਇਸ ਵਿੱਚ ਮੈਂ ਕਾਫੀ ਜ਼ਿਆਦਾ ਮਾਤਰਾ ਵਿੱਚ ਡਰਾਈ ਫਰੂਟਸ ਪਾਉਂਦਾ ਹਾਂ ਜਿਵੇਂ ਕਿ ਕਿਸਮਿਸ਼ ਬਦਾਮ ਦਾਖਾਂ ਨਾਰੀਅਲ ਦਾ ਬੁਰਾਦਾ ਅਤੇ ਹੋਰ ਵੱਖੋ ਵੱਖਰੇ ਡਰਾਈ ਫਰੂਟ ਦਾ ਵੀ ਇਸਤੇਮਾਲ ਮੈਂ ਕਰਦਾ ਹਾਂ ਤਾਂ ਜੋ ਖੀਰ ਬਹੁਤ ਹੀ ਵਧੀਆ ਤਰੀਕੇ ਨਾਲ ਅਤੇ ਸਵਾਦਿਸ਼ਟ ਬਣ ਸਕੇ ਕੁਝ ਸਮੇਂ ਦੀ ਵੇਟ ਤੋਂ ਬਾਅਦ ਮੇਰੀ ਖੀਰ ਬਣਨ ਲਈ ਤਿਆਰ ਹੋ ਜਾਂਦੀ ਹੈ ਅਤੇ ਮੈਨੂੰ ਖੁਦ ਦੀ ਬਣਾਈ ਹੋਈ ਖੀਰ ਸ਼ੁਰੂ ਤੋਂ ਅਤੇ ਬਚਪਨ ਤੋਂ ਹੀ ਪਸੰਦ ਹੈ ਮੈਂ ਬਚਪਨ ਤੋਂ ਹੀ ਖੀਰ ਨੂੰ ਬਣਾਉਣਾ ਸਿੱਖ ਗਿਆ ਸੀ ਇਹ ਖੀਰ ਮੈਨੂੰ ਮੇਰੀ ਮੰਮੀ ਜੀ ਨੇ ਸਿਖਾਈ ਸੀ ਖੀਰ ਨੂੰ ਬਣਾਉਣਾ ਬਹੁਤ ਹੀ ਆਸਾਨ ਹੁੰਦਾ ਹੈ ਮੈਂ ਹਫਤੇ ਵਿੱਚ ਤਿੰਨ ਤੋਂ ਚਾਰ ਵਾਰ ਖੀਰ ਬਣਾਉਂਦਾ ਹਾਂ ਅਤੇ ਡਰਾਈ ਫਰੂਟ ਦੇ ਨਾਲ ਉਸਨੂੰ ਖਾਂਦਾ ਹਾਂ ਕੁਝ ਸਮੇਂ ਦੀ ਵੇਟ ਤੋਂ ਬਾਅਦ ਮੇਰੀ ਵਧੀਆ ਅਤੇ ਮਿੱਠੀ ਮਿੱਠੀ ਖੀਰ ਬਣ ਜਾਂਦੀ ਹੈ ਜਦੋਂ ਮੈਂ ਉਸਨੂੰ ਦੇਖਦਾ ਹਾਂ ਉਹ ਦੇਖਣ ਵਿੱਚ ਹੀ ਬਹੁਤ ਵਧੀਆ ਅਤੇ ਸੁੰਦਰ ਦਿਖਾਈ ਦਿੰਦੀ ਹੈ ਜਦੋਂ ਮੈਂ ਆਪਣੀ ਖ਼ੀਰ ਨੂੰ ਪਰੋਸਣ ਲਈ ਬਰਤਨ ਵਿੱਚ ਪਾਉਂਦਾ ਹਾਂ ਤਾਂ ਉਸਦੀ ਸੁਗੰਧ ਬਹੁਤ ਜ਼ਿਆਦਾ ਵਧੀਆ ਅਤੇ ਮਿੱਠੀ ਹੁੰਦੀ ਹੈ ਮੈਨੂੰ ਖੀਰ ਬਹੁਤ ਹੀ ਪਸੰਦ ਇਸ ਕਰਕੇ ਹੈ ਕਿਉਂਕਿ ਉਹ ਸਾਰੇ ਪਕਵਾਨਾਂ ਵਿੱਚੋਂ ਮਿੱਠਾ ਪਕਵਾਨ ਮੰਨਿਆ ਜਾਂਦਾ ਹੈ